ਪਤਾ ਨਹੀਂ ਹੈਲੋ ਕੀ ਹਾਲ ਆ ਬਹੁਤ ਵਧੀਆ ਤੂੰ ਸੁਣਾ ਬਾਈ ਹੋਰ ਠੀਕ ਠਾਕ ਆ ਬਸ ਵਧੀਆ ਭਰਾਵਾ ਠੀਕ ਠਾਕ ਉਹ ਯਾਰ ਸੁਣ ਹਾਂ ਹਾਂ ਉਹ ਪਤਾ ਕੀ ਸਕੂਟਰੀ 'ਤੇ ਮੈਂ ਤਾਂ ਤੇਜ਼ ਗਿਆ ਸੀ ਮੇਰਾ ਪੋਤਾ ਪੜ੍ਹਦਾ ਟਊਸ਼ਨ 'ਤੇ ਯਾਰ ਹਾਂ ਅਤੇ ਆਪਣੇ ਬਰਨਾਲੇ 'ਚ ਬੁਰਾ ਹਾਲ ਹੈ ਟ੍ਰੈਫਿਕ ਦਾ ਤਾਂ ਐਂਏਂ ਆ ਵੀ ਇੱਕ ਤਿਉਹਾਰਾਂ ਦੇ ਦਿਨ ਹੈਗੇ ਤਿਉਹਾਰ 'ਤੇ ਜਵਾਕਾਂ ਨੂੰ ਐਕਟੀਵਾ ਮੈਂ ਫੜਾਉਂਦਾ ਨਹੀਂ ਮੈਨੂੰ ਐਂਏ ਹੁੰਦਾ ਵੀ ਆਪ ਹੀ ਲਿਆ ਕੇ ਮੈਂ ਆਪ ਹੀ ਲੈ ਆਵਾਂ ੳ ਹਾਂ ਹਾਂ ਉਹ ਉਹ ਟਿਊਸ਼ਨ ਪੜ੍ਹਦਾ ਗਾ ਮੈਂ ਕਿਹਾ ਛੋਟੇ ਬੱਚਿਆਂ ਤੋਂ ਕਿੱਥੋਂ ਲੋਟ ਆਉਂਦਾ ਨਾ ਇੰਨੀ ਟ੍ਰੈਫਿਕ ਦਾ ਆਪਦਾ ਬੁਰਾ ਹਾਲ ਹੋ ਜਾਂਦਾ ਯਾਰ ਹਾਂ ਹਾਂ ਮੁੜ ਕੇ ਚਲੋ ਵ ਵੇਲਾ ਹੱਥ ਨਹੀਂ ਆਉਂਦਾ ਹੈਗਾ ਹੈ ਨਾ ਫੇਰ ਐਂ ਲੱਗਦਾ ਆਪ ਹੀ ਚੱਲ ਵੜੋ ਆਪ ਤੋਂ ਵੀ ਯਾਰ ਲੰਘਣਾ ਇੰਨਾ ਔਖਾ ਹੋਇਆ ਪਿਆ ਹੈਗਾ ਕਿੰਨਾ ਧਿਆਨ ਨਾਲ ਦੇਣਾ ਕੀ ਹੈ ਹੈ ਨਾ ਇੰਨਾ ਭੀੜ ਭੜੱਕਾ ਪਿਆ

ਹਾਂ ਹਾਂ ਕਿਉਂਕਿ ਇੱਕ ਜਿਹੜਾ ਯਾਰ ਆਪਾਂ ਘਰ ਦੀ ਕਟਾਈ ਹੈ ਝੋਨੇ ਦੀ ਹੈ ਉਹ ਟਰਾਲੀਆਂ ਜੱਟਾਂ ਦੀਆਂ ਜਿੰਨੇ ਟਰੈਕਟਰ ਨਾਲ ਦੇ ਉੱਪਰ ਉਹ ਡੈੱਕ ਲਾਏ ਉਹ ਨਹੀਂ ਸੁਣਦੇ ਪਤੰਦਰ ਵਾਸਤਾ ਨਹੀਂ ਉਹ ਭਜਾਈ ਲਈ ਜਾਂਦੇ ਹੈ ਹੈ ਨਾ ਹੋਰ ਹੋਰ

ਅੱਛਾ ਅੱਛਾ ਅੱਛਾ

ਹਾਂਜੀ ਹਾਂਜੀ ਅੱਛਾ ਬੋਲੋ ਅੱਛਾ ਹੋਰ ਸੁਣਾਓ ਫੇਰ ਤਾਂ ਬਹੁਤ ਮਾੜਾ ਹੋਇਆ ਯਾਰ ਹਾਂ ਹਾਂ ਹਾਂ ਹਾਂ ਇਹ ਵੀ ਗੱਲ ਹੈਗੀ ਆ ਬਾਈ ਉਹ ਯਾਰ ਤੂੰ ਆਪਾਂ ਦੇਖ ਲਾ ਆਪਾਂ ਤਾਂ ਪੈਦਲ ਤੁਰਦੇ ਸੀ ਆਪਾਂ ਨੂੰ ਵੀ ਇਹ ਸਕੂਟਰੀਆਂ ਜਿਹੀਆਂ ਨਵੀਆਂ ਚੱਲ ਪਈਆਂ ਬਿਜਲੀ ਵਾਲੀਆਂ ਇਹਨਾਂ ਦਾ ਸਵਾਦ ਪੈ ਗਿਆ ਹਾਂ ਹਾਂ ਹੋਰ ਹੋਰ ਹੋਰ ਫੇਰ ਬਸ ਬਸ ਆਂਈਂ ਹੈ ਭੱਜਣ ਦਾ ਤਾਂ ਕੀ ਭਰਾਵਾ ਆਂਈ ਤੁਰਿਆ ਫਿਰਦਾ ਮੈਂ ਕਦੇ ਜਵਾਕ ਛੱਡ ਆਇਆ ਟਿਊਸ਼ਨ 'ਤੇ ਪੋਤੇ ਪੋਤੀਆਂ ਨੂੰ ਕਦੇ ਲੈ ਆਇਆ ਹਾਂ ਹਾਂ ਹਾਂ ਹਾਂ ਹਾਂ ਪੰਜਵਾਂ ਇਹ ਹੁੰਦਾ ਵੀ ਟ੍ਰੈਫਕ ਬਹੁਤ ਆ ਮੈਂ ਤਾਂ ਕਿਹਾ ਬਾਈ ਟ੍ਰੈਫਕ ਆ ਭਾਈ ਤੂੰ ਨਹੀਂ ਚਲਾਉਣਾ ਮੈਂ ਤੈਨੂੰ ਔਖਾ ਸੌਖਾ ਆਪ ਛੱਡ ਕੇ ਆਊਂਗਾ ਆਪ ਹੀ ਲੈ ਕੇ ਆਊਂਗਾਂ ਹੈ ਨਾ

ਹਾਂ ਹਾਂ ਹਾਂ ਹਾਂ ਹੱਦ ਆ ਹਾਂ ਹਾਂ ਹਾਂ ਹਾਂ ਉਹਦਾ ਵੀ ਧਿਆਨ ਹਾਂ ਕਾਹਲੀ ਹੈ ਉਹਦਾ ਜਦੋਂ ਕਚਹਿਰੀ ਰੋਡ ਦੇ ਉੱਪਰ ਤਾਂ ਟ੍ਰੈਫਿਕ ਵਾਲੇ ਖੜ੍ਹੇ ਹੁੰਦੇ ਉਹ ਮੈਨੂੰ ਬਹੁਤ ਵਧੀਆ ਲੱਗਦਾ ਉਹ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੈਗੇ ਪਰ ਫੇਰ ਵੀ ਕੀ ਹੈ ਫੜਦੇ ਨਹੀਂ ਭਜਾ ਭਜਾ ਕੇ ਪਤੰਦਰ ਆਂਈ ਕੱਢੀ ਜਾਂਦੇ ਹੈਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਤੇਜ਼ ਚਲਾਉਣ ਦੀ ਜ਼ਰੂਰਤ ਆ ਜੀ ਸਭ ਨੂੰ ਹਾਂਜੀ ਹਾਂਜੀ ਹਾਂਜੀ ਹੋਰ ਬਸ ਆਹੀ ਹੈ ਦੁਨੀਆ ਦਾ ਕੀ ਕਹਿੰਦੇ ਹੁੰਦੇ ਹੈ ਪਤਾ ਨਹੀਂ ਕਿੱਧਰ ਨੂੰ ਚੱਲੀ ਜਾਂਦੀ ਹੈ ਭੱਜ ਹਫੜੋ ਦਫੜੀ ਇੱਧਰ ਵਗ ਗਏ ਉੱਧਰ ਬਸ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂਜੀ ਹਾਂਜੀ ਬਿਲੁਕਲ ਬਿਲਕੁਲ ਹਾਂ ਹਾਂ ਇਹ ਤਾਂ ਹੈ ਬਾਈ ਮੇਰੇ ਕੋਲ ਹੋਰ ਮਾਰ ਲਿਓ ਭਾਈ ਗੇੜਾ ਕਦੇ ਸਾਡੇ ਵੱਲ ਹਾਂ ਹਾਂ ਹੋ ਗਿਆ ਬਹੁਤ ਟੈਮ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਬਾਈ ਓਕੇ ਸਤਿ ਸ਼੍ਰੀ ਅਕਾਲ ਬਾਈ